ਪੰਜਾਬ ਨੂੰ ਤਿਉਹਾਰਾਂ ਦਾ ਹੀ ਰਾਜ ਕਿਹਾ ਜਾਂਦਾ ਹੈ ਇੱਥੇ ਹਰ ਤਰ੍ਹਾਂ ਦੇ ਤਿਉਹਾਰ ਮਨਾਏ ਜਾਂਦੇ ਹਨ ਕਿਉਂਕਿ ਇੱਥੇ ਹਰ ਧਰਮਾਂ ਦੇ ਲੋਕ ਰਹਿੰਦੇ ਹਨ ਅਤੇ ਉਹ ਇਕੱਠੇ ਹੋ ਕੇ ਸੈਲੀਬਰੇਟ ਕਰਦੇ ਹਨ ਜਿਹੜਾ ਤਿਉਹਾਰ ਇੱਥੇ ਮ ਪੰਜਾਬ 'ਚ ਮਨਾਇਆ ਜਾਂਦਾ ਉਹ ਅਸੀਂ ਸਾਰੇ ਹੀ ਮਨਾਉਂਦੇ ਹਾਂ ਜਿਵੇਂ ਵਿਸਾਖੀ ਲੋਹੜੀ ਗੁਰਪੁਰਬ ਤੀਜ ਦਿਵਾਲੀ ਕ੍ਰਿਸਮਿਸ ਆਦਿ ਵਿਸਾਖੀ ਜਿਹੜਾ ਤਿਉਹਾਰ ਹੈ ਉਹ ਕੋ ਖੁਸ਼ੀ ਨਾਲ ਮਨਾਇਆ ਜਾਂਦਾ ਪੰਜਾਬ ਦੀ ਖੇਤੀ ਦਾ ਤਿਉਹਾਰ ਹੈ ਇਹ ਲੋਕਾਂ ਨੇ ਇਹਨਾਂ ਨੂੰ ਪੰਜਾਬ ਦਾ ਨਵਾਂ ਸਾਲ ਵੀ ਮਨਾਉਣਾ ਸ਼ੁਰੂ ਕੀਤਾ ਹੈ ਜਿਹੜਾ ਲੋਹੜੀ ਹੈ ਉਹ ਵੀ ਬੜੇ ਉਤਸ਼ਾਹ ਨਾਲ ਮਨਾਇਆ ਜਾਂਦਾ ਹੈ ਇਹ ਪੰਜਾਬੀਆਂ ਦੁਆਰਾ ਧਰਤੀ ਦਾ ਧੰਨਵਾਦ ਕਰਨ ਲਈ ਮਨਾਇਆ ਜਾਂਦਾ ਲੋਕ ਰਾਤ ਨੂੰ ਭੰਗੜੇ ਪਾਉਂਦੇ ਹਨ ਅਤੇ ਅੱਗ ਬਾਲਦੇ ਹਨ ਅਤੇ ਪ੍ਰਸ਼ਾਦ ਵੀ ਬਣਾਉਂਦੇ ਹਨ ਗੁਰਪੁਰਬ ਗੁਰਪੁਰਬ ਜਿਹੜਾ ਤਿਉਹਾਰ ਹੈ ਧਾਰਮਿਕ ਹੀ ਤਿਉਹਾਰ ਹੈ ਇਹ ਗੁਰੂ ਨਾਨਕ ਦੇਵ ਜੀ ਗੁਰੂ ਗੋਬਿੰਦ ਸਿੰਘ ਅਤੇ ਹੋਰ ਗੁਰੂ ਸਾਹਿਬਾਂ ਦੀ ਜਯੰਤੀ ਨੂੰ ਮਨਾਉਣ ਲਈ ਮਨਾਇਆ ਜਾਂਦਾ ਹੈ ਤੀਜ ਤਿਉਹਾਰ ਜਿਹੜਾ ਸਾਉਣ ਦੇ ਮਹੀਨੇ ਵਿੱਚ ਆਉਂਦਾ ਹੈ ਇਹ ਕੁੜੀਆਂ ਦੁਆਰਾ ਹੀ ਜ਼ਿਆਦਾਤਰ ਤਾਂ ਮਨਾਇਆ ਜਾਂਦਾ ਕੁੜੀਆਂ ਗਿੱਧਾ ਪਾਉਂਦੀਆਂ ਹਨ ਨੇ ਅਤੇ ਵਰਤ ਰੱਖਦੀਆਂ ਹਨ ਆਪਣੇ ਪਤੀ ਦੀ ਲੰਬੀ ਉਮਰ ਦੇ ਲਈ ਇਸ ਤੋਂ ਬਾਅਦ ਦਿਵਾਲੀ ਤਿਉਹਾਰ ਜਿਸ ਵਿੱਚ ਲੋਕ ਆਪਣੇ ਘਰਾਂ ਨੂੰ ਸਜਾਉਂਦੇ ਹਨ ਦੀਵਿਆਂ ਨਾਲ ਦੀਪਮਾਲਾ ਨਾਲ ਅਤੇ ਛੋਟੇ ਵੱਡੇ ਬੱਚੇ ਸਾਰੇ ਨਵੇਂ ਕੱਪੜੇ ਪਾ ਕੇ ਦਿਵਾਲੀ ਨੂੰ ਮਨਾਉਂਦੇ ਹਨ ਇਸ ਤੋਂ ਬਾਅਦ ਆ ਜਾਂਦਾ ਕ੍ਰਿਸਮਿਸ ਕ੍ਰਿਸਮਿਸ ਤਿਉਹਾਰ ਵੈਸੇ ਤਾਂ ਇਸਾਈਆਂ ਦਾ ਤਿਉਹਾਰ ਹੈ ਪਰ ਇਹ ਪੰਜਾਬ ਵਿੱਚ ਵੀ ਮਨਾਇਆ ਜਾਂਦਾ ਹੈ ਇਹ ਤਿਉਹਾਰ ਇਸਾ ਮਸੀਹ ਦੇ ਜਨਮਦਿਨ ਨੂੰ ਮਨਾਉਣ ਮਨਾਉਂਦਾ ਹੈ ਕਿਸਮ ਦੇ ਇੱਥੇ ਹਰ ਕ ਕ੍ਰਿਸਮਿਸ ਦੇ ਦਿਨ ਲੋਕ ਆਪਣੇ ਗੁਰੂ ਘਰ ਨੂੰ ਖੁਸ਼ੀ ਨਾਲ ਸਜਾਉਂਦੇ ਹਨ